ਹੈਲੋ ਰੋਹਨ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਹਾਂ ਪ੍ਰਾਈਜ ਤਾਂ ਦੇਖੋ ਬਈ ਵੀਰੇ ਅਲੱਗ ਅਲੱਗ ਹੁੰਦੇ ਨੇ ਠੀਕ ਹੈ ਨਾ ਪ੍ਰੀ ਵੈਡਿੰਗ ਦਾ ਆ ਵੀ ਡੈਸਟੀ ਆਪਣੀ ਡੈਸਟੀਨੇਸ਼ਨ ਅਤੇ ਡਿਪੈਂਡ ਕਰਦਾ ਗਾ ਵੀ ਤੁਸੀਂ ਲੋਕਲ ਪੰਜਾਬ 'ਚ ਕਰਨੀ ਆ ਜਾਂ ਬਾਹਰ ਕਰਨੀ ਆ ਫਿਰ ਉਸ ਹਿਸਾਬ ਨਾਲ ਉਹਦੀ ਲੋਕੇਸ਼ਨ ਤੈਅ ਹੁੰਦੀਆਂ ਨੇ ਕਿਹੜੇ ਕਿਹੜੇ ਆਪਾਂ ਵੀ ਕਿੰਨੇ ਬੰਦੇ ਸਾਡੇ ਜਨ ਜਾਂਦੇ ਨੇ ਤਾਂ ਉਹਦੇ ਹਿਸਾਬ ਤਰੀਕੇ ਕਿੰਨੇ ਦਿਨ ਹੁੰਦੇ ਨੇ ਉੱਥੇ ਸਪੈਂਡ ਹੁੰਦੇ ਨੇ ਤਾਂ ਉਹਦੇ ਹਿਸਾਬ ਨਾਲ ਹੁੰਦਾ ਜੀ ਸਾਰਾ ਖ਼ਰਚਾ ਹਾਂਜੀ ਹਾਂਜੀ ਉਦੋਂ ਆ ਪੰਜਾ 'ਚ ਕੋਈ ਗੱਲ ਨਹੀਂ ਤੁਸੀਂ ਆਪਣਾ ਵਿਜਿਟ ਕਰ ਲਓ ਜੀ ਸ਼ੋਪ 'ਤੇ ਅਸੀਂ ਤੁਹਾਨੂੰ ਸਾਰੇ ਜਿਹੜੇ ਪਲੈਨਜ਼ ਹੈਗੇ ਨੇ ਉਹ ਦਸ ਦੱਸ ਦਵਾਂਗੇ ਵੀ ਪੰਜਾਬ 'ਚ ਕਿਹੜੀਆਂ ਕਿਹੜੀਆਂ ਲੋਕੇਸ਼ਨ ਨੇ ਇਸ ਵੱਲ ਇਸ ਵਕਤ ਹੈਗੀਆਂ ਨੇ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਵਿਆਹ ਦੀ ਤਰੀਕ ਦੇਖਣੀ ਹੋ ਗਈ ਉਸ ਤੋਂ ਪਹਿਲਾਂ ਅਤੇ ਉਹ ਡੇਟਾਂ ਦੇਖਣੀਆਂ ਪੈਣੀਆਂ ਸਾਰੀਆਂ ਚੀਜ਼ਾਂ ਅਲੱਗ ਅਲੱਗ ਲੋਕੇਸ਼ਨ ਦੇ ਕਿਉਂਕਿ ਤੁਹਾਨੂੰ ਪਤਾ ਅੱਗੇ ਵਿਆਹ ਬਹੁਤ ਜ਼ਿਆਦਾ ਨੇ ਹਾਂ ਹਾਂ ਤਾਂ ਕਰਕੇ ਉਹ ਸਾਰੀਆਂ ਡੈਸਟੀਨੇਸ਼ਨਾ ਲੋਕੇਸ਼ਨ ਦੇਖ ਕੇ ਹਾਂ ਬਿਲਕੁਲ ਬਿਲਕੁਲ ਸਾਰੀਆਂ ਲੋਕੇਸ਼ਨਾਂ ਦੇਖ ਕੇ ਫਿਰ ਉਸ ਹਿਸਾਬ ਨਾਲ ਆਪਾਂ ਕਰ ਦਵਾਂਗੇ ਤੁਹਾਨੂੰ ਸਾਰਾ

ਬਰਨਾਲੇ ਨਹੀਂ ਨਹੀਂ ਬਰਨਾਲੇ 'ਚ ਨਹੀਂ ਹੈਗੀ ਗੀ ਆਪਣੇ ਜਿਵੇਂ ਬਠਿੰਡਾ ਸਾਈਡ ਹੋ ਗਈ ਸੰਗਰੂਰ ਸਾਈਡ ਹੋ ਗਈ ਹਾਂ ਹਾਂ ਇੱਧਰ ਲੁਧਿਆਣਾ ਹੋ ਗਈ ਪਟਿਆਲਾ ਹੋ ਗਈ ਮੋਹਾਲੀ ਚੰਡੀਗੜ੍ਹ ਇੱਧਰ ਜ਼ਿਆਦਾ ਗੀ ਜਿਵੇਂ ਆਪ ਜੀ ਆਪਾਂ ਨੂੰ ਸਾਰਿਆਂ ਨਾਲੋਂ ਤੁਸੀਂ ਨੇੜੇ ਦੇਖਣੀ ਹੈ ਤਾਂ ਇੱਧਰ ਮਾਨਸਾ ਦੀ ਹੈਗੀ ਆ ਮਾਨਸਾ ਕੰਨੀ ਹੈਗੀ ਇੱਕ ਅਤੇ ਇੱਕ ਬਠਿੰਡਾ ਸਾਈਡ ਆ

ਅੱਛਾ ਅੱਛਾ ਜੀ ਠੀਕ ਠੀਕ ਹੈ ਜੀ ਹਾਂ ਨਾ ਨਾ ਅਗਾਂਹ ਉਹ ਹੀ ਅ ਵੀ ਹਾਂ ਕੰਮ ਆਪਣਾ ਵਧੀਆ ਸਾਰਾ ਇੱਕ ਨੰਬਰ 'ਚ ਕੋਈ ਦਿੱਕਤ ਨਹੀਂ ਹੈਗੀ ਗੀ ਠੀਕ ਹੈ ਨਾ ਨਹੀਂ ਰੇਟ ਤੁਹਾਨੂੰ ਦੱਸਿਆ ਵੀ ਜਾਂ ਲੋਕੇਸ਼ਨ ਦੇ ਹਿਸਾਬ ਨਾਲ ਹੁੰਦਾ ਅਤੇ ਕਿੰਨੇ ਦਿਨ ਦਾ ਸ਼ੂਟ ਆ ਉਸ ਹਿਸਾਬ ਨਾਲ ਹੁੰਦਾ ਗਾ ਠੀਕ ਹੈ ਨਾ ਜੀ ਜੇ ਮਤਲਬ ਹੁਣ ਇਹਦੇ ਵਿੱਚ ਇਹ ਆ ਵੀ ਆਪਾਂ ਪਿਕ ਕਿਹੜੀ ਤਿਆਰ ਕਰਨੀ ਹੈ ਫੋਰ ਕੇ ਤਿਆਰ ਕਰਨੀ ਆ ਜਾਂ ਸਿਰਫ਼ ਇਕੱਲੀ ਐਚ ਡੀ ਤਿਆਰ ਕਰਨੀ ਆ ਵੀ ਤੁਸੀਂ ਜਿਹੜੇ ਗਾਂਹ ਤੁਹਾਡੀ ਜਿਹੜੀਆਂ ਡਰੈਸ ਨੇ ਉਹ ਅਸੀਂ ਲੈ ਕੇ ਆਵਾਂਗੇ ਜਾਂ ਤੂ ਤੁਹਾਡੀ ਆਪਣੀਆਂ ਹੋਣਗੀਆਂ ਅਤੇ ਇਸ ਹਿਸਾਬ 'ਤੇ ਫਿਰ ਸਾਰਾ ਉਹਦਾ ਬਜਟ ਬਣਦਾ ਹੁੰਦਾ ਗਾ ਠੀਕ ਹੈ ਨਾ ਫਿਰ ਉਸ ਹਿਸਾਬ ਨਾਲ ਫਿਰ ਸਾਰਾ ਖਰਚਾ ਤੁਹਾਨੂੰ ਦੱਸ ਦਵਾਂਗੇ ਤੁਸੀਂ ਕੋਈ ਨਾ ਕੋਈ ਦਿੱਕਤ ਨਹੀਂ ਤੁਸੀਂ ਇੱਕ ਵਾਰ ਵਿਜਿਟ ਕਰੋ ਸ਼ੋਪ 'ਤੇ ਹਾਂਜੀ ਠੀਕ ਹੈ